ਪੰਦਰ੍ਹਾਂ ਅਗਸਤ ਉੱਨੀ ਸੌ ਸੰਤਾਲੀ ਛੱਬੀ ਜਨਵਰੀ ਉੱਨੀ ਸੌ ਪੰਜਾਹ ਇੱਕੀ ਅਗਸਤ ਉੱਨੀ ਸੌ ਸਤਾਨਵੇਂ ਗਿਆਰ੍ਹਾਂ ਫਰਵਰੀ ਦੋ ਹਜ਼ਾਰ ਦੋ ਸੱਤ ਅਕਤੂਬਰ ਦੋ ਹਜ਼ਾਰ